ਜੇਕਰ ਮੈਨੂੰ ਆਪਣੀਆਂ ਤਸਵੀਰਾਂ ਰਾਹੀਂ ਭਾਰਤ ਨੂੰ ਦਿਖਾਉਣ ਦਾ ਮੌਕਾ ਮਿਲੇ ਤਾਂ ਮੈਂ ਇੱਥੋਂ ਦੀਆਂ ਪ੍ਰਸਿੱਧ ਜਗ੍ਹਾ 'ਤੇ ਜਾ ਕੇ ਤਸਵੀਰਾਂ ਲੈਣੀਆਂ ਚਾਹਾਂਗੀ ਜਿਵੇਂ ਕਿ ਗੋਲਡਨ ਟੈਂਪਲ ਜੋ ਕਿ ਇੱਕ ਸਵਰਨ ਮੰਦਰ ਹੈ ਇਹ ਸਿੱਖਾਂ ਦਾ ਬਹੁਤ ਹੀ ਪ੍ਰਸਿੱਧ ਗੁਰਦੁਆਰਾ ਹੈ ਔਰ ਇੱਥੇ ਲਾਗੇ ਹੀ ਇੱਕ ਜਲਿਆਂਵਾਲਾ ਬਾਗ ਹੈ ਜਿੱਥੇ ਕਿ ਇੱਕ ਘਟਨਾ ਬਹੁਤ ਪੁਰਾਣੀ ਘਟਨਾ ਵਾਪਰੀ ਸੀ ਇਸ ਨੂੰ ਦਰਸਾਇਆ ਗਿਆ ਹੈ ਔਰ ਉਸ ਤੋਂ ਅੱਗੇ ਆਪਾ ਜਾਈਏ ਤਾਂ ਬਾਘਾ ਬਾਡਰ ਹੈ ਜੋ ਕਿ ਹਿੰਦੁਸਤਾਨ ਅਤੇ ਪਾਕਿਸਤਾਨ ਦਾ ਉੱਥੇ ਗੇਟ ਲੱਗਦਾ ਹੈ ਇੱਥੋਂ ਦੀਆਂ ਹੋਰ ਵੀ ਬਹੁਤ ਸਾਰੀਆਂ ਪ੍ਰਸਿੱਧ ਜਗ੍ਹਾਵਾਂ ਹਨ ਜਿਵੇਂ ਕਿ ਲਾਲ ਕਿਲ੍ਹਾ ਔਰ ਤਾਜ ਮਹਿਲ ਤਾਜ ਮਹਿਲ ਇੱਕ ਪ੍ਰੇਮ ਦਾ ਪ੍ਰਤੀਕ ਹੈ ਜੋ ਕਿ ਬਹੁਤ ਹੀ ਸੋਹਣਾ ਬਣਿਆ ਹੈ ਇਹ ਬਹੁਤ ਹੀ ਦੇਖਣ ਨੂੰ ਆਕਰਸ਼ਕ ਲੱਗਦਾ ਹੈ ਔਰ ਇੱਥੇ ਬਹੁਤ ਸਾਰੀਆਂ ਜਗ੍ਹਾਵਾਂ ਜਿਵੇਂ ਕਿ ਸ਼ਹਿਰ ਮੁੰਬਈ ਹੈ ਉਹ ਇੱਕ ਫਿਲਮ ਸਿਟੀ ਹੈ ਔਰ ਗੋਆ ਜਿੱਥੇ ਕਿ ਬਹੁਤ ਸੋਹਣੀ ਬੀਚ ਹੈ ਉੱਥੇ ਲੋਕ ਜਾਣਾ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹਨ ਧੰਨਵਾਦ